ਇੱਕ ਵਿਅਕਤੀ ਲਈ ਲਿਖਣ ਲਈ ਬਹੁਤ ਸਾਰੀਆਂ ਸ਼ੈਲੀਆਂ ਹੋ ਸਕਦੀਆਂ ਹਨ ਜਿਸ ਦੇ ਵਿੱਚ ਮੈਨੂੰ ਲਿਖਣ ਵਿੱਚ ਇੱਕ ਸ਼ੈਲੀ ਜਿਵੇਂ ਕਿ ਇੱਕ ਤਰ੍ਹਾਂ ਦੀ ਸ਼ੈਲੀ ਜਿਵੇਂ ਕਿ ਜੀਵਨੀ ਲਿਖਣੀ ਬਹੁਤ ਪਸੰਦ ਹੈ ਕਿਉਂਕਿ ਉਸ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਹਾਂ ਅਸੀਂ ਆਪਣੇ ਬਾਰੇ ਲਿਖ ਸਕਦੇ ਹਾਂ ਅਤੇ ਜੋ ਕਿ ਸਾਡੇ ਜੀਵਨ ਦੇ ਵਿੱਚ ਰੋਜ਼ਾਨਾ ਜੀਵਨ ਦੇ ਵਿੱਚ ਘਟਨਾਵਾਂ ਜਾਂ ਸਾਡੇ ਤਜਰਬੇ ਹਨ ਉਸ ਨੂੰ ਬਿਆਨ ਕਰ ਸਕਦੇ ਹਾਂ ਅਸੀਂ ਮੈਂ ਇਸ ਤੋਂ ਇਲਾਵਾ ਇਲਾਵਾ ਨਾਵਲ ਪੜ੍ਹਨ ਦੇ ਵਿੱਚ ਰੁਚੀ ਰੱਖਦੀ ਹਾਂ ਨਾਵਲ ਦੀ ਖੋਜ ਜਿੱਥੇ ਪ੍ਰਯੋਗ ਲਈ ਮੈਂ ਬਹੁਤ ਸਾਰੇ ਪੁਰਾਣੇ ਨਾਵਲ ਜਾਂ ਜੋ ਹੁਣ ਆ ਰਹੇ ਹਨ ਉਹਨਾਂ ਨੂੰ ਪੜ੍ਹਦੀ ਹਾਂ ਅਤੇ ਉਹਨਾਂ ਤੋਂ ਸੁਝਾਅ ਲੈਂਦੀ ਹਾਂ ਕਿ ਜਿਵੇਂ ਉਨਾਂ ਨੇ ਉਹਨਾਂ ਨੇ ਨਾਵਲ ਵਿੱਚ ਲਿਖਿਆ ਹੋਇਆ ਹੈ ਜੋ ਕਿ ਪੜ੍ਹਨ ਦੇ ਵਿੱਚ ਇੱਦਾਂ ਲੱਗਦਾ ਹੈ ਕਿ ਜਿਵੇਂ ਉਹ ਸਾਡੇ ਆਪਣੇ ਆਪ ਅੱਖਾਂ ਦੇ ਸਾਹਮਣੇ ਉਹ ਸਾਰਾ ਦ੍ਰਿਸ਼ ਬਣ ਜਾਂਦਾ ਹੈ ਜਿਵੇਂ ਜਿਵੇਂ ਨਾਵਲ ਨੂੰ ਪੜ੍ਹਦੀ ਹਾਂ ਇਸ ਲਈ ਮੈਨੂੰ ਨਾਵਲ ਪੜ੍ਹਨਾ ਲਿਖਣਾ ਬਹੁਤ ਪਸੰਦ ਹੈ ਨਾਵਲ ਦੇ ਵਿੱਚ ਜਿਵੇਂ ਕਿ ਕਿਸੇ ਵਿਅਕਤੀ ਦਾ ਜਗ੍ਹਾ ਦਾ ਜ਼ਿਕਰ ਵੀ ਹੋ ਸਕਦਾ ਹੈ ਹੁੰਦਾ ਹੈ ਇਸ ਲਈ ਮੈਨੂੰ ਨਾਵਲ ਦੇ ਵਿੱਚ ਜੋ ਕਿ ਨਾਵਲ ਵੀ ਇੱਕ ਪ੍ਰਕਾਰ ਦੀ ਸ਼ੈਲੀ ਹੈ ਉਹ ਮੈਨੂੰ ਬਹੁਤ ਪਸੰਦ ਹੈ